ਹੈਲੋ ਭਾਅ ਜੀ ਸਤਿ ਸ੍ਰੀ ਅਕਾਲ ਜੀ ਭਾਅ ਜੀ ਘਨੌਲੀ ਤੋਂ ਹੈਪੀ ਬੋਲ ਰਹੇ ਹੋ ਤੁਸੀਂ ਮੈਂ ਤੁਹਾਡਾ ਨੰਬਰ ਲਿੱਤਾ ਸੀਗਾ ਭਾਅ ਜੀ ਉਹ ਨਾ ਗੁਰੀ ਤੋਂ ਜਿਹੜਾ ਸਮਰਾਲੇ ਰਹਿੰਦਾ ਹੈ ਜੀ ਉਹ ਤੋਂ ਨੰਬਰ ਲਿੱਤਾ ਸੀਗਾ ਜੀ ਅਤੇ ਉਹਨੇ ਨੰਬਰ ਦਿੱਤਾ ਸੀਗਾ ਜੀ ਭਾਅ ਜੀ ਵਧੀਆ ਡਰਾਈਵਰ ਆ ਅਤੇ ਟੂਰ ਟਾਰ ਆ ਕਾਫ਼ੀ ਲੈ ਕੇ ਜਾਂਦੇ ਅੱਗੇ ਅਤੇ ਭਾਅ ਜੀ ਆਪਾਂ ਨੇ ਜਾਣਾ ਮਨਾਲੀ ਸਾਈਡ ਘੁੰਮਣ ਲਈ ਮਨਾਲੀ ਮਨੀਕਰਨ ਸਾਹਿਬ ਜਾਣਾ ਜੀ ਅਤੇ ਤੁਸੀਂ ਪੰਜ ਤਰੀਕ ਨੂੰ ਫ੍ਰੀ ਹੈਗੇ ਹੈ ਜੀ ਆਪਾਂ ਨੇ ਸਵੇਰ ਪੰਜ ਵਜੇ ਨਿਕਲਣਾ ਹੈ ਜੀ ਅਤੇ ਆਪਾਂ ਨੇ ਭਾਅ ਜੀ ਕੋਈ ਜਲਦੀ ਨਹੀਂ ਕਰਨੀ ਹੈਗੀ ਰਸਤੇ ਵਿੱਚ ਨਾ ਗੱਡੀ ਤੇਜ਼ ਚਲਾਉਣੀ ਹੈ ਭਾਅ ਜੀ ਆਰਾਮ ਨਾਲ ਜਾਣਾ ਭਾਅ ਜੀ ਆਰਾਮ ਨਾਲ ਵਾਪਿਸ ਆਉਣਾ ਅਤੇ ਆਪਾਂ ਨੇ ਥੋੜ੍ਹਾ ਜਿਹਾ ਦਸ ਕੁ ਦਿਨ ਲੱਗ ਜਾਣੇ ਅਤੇ ਥੋੜ੍ਹੇ ਜਿਹੇ ਆਪਾਂ ਥਾਵਾਂ ਪਰ ਦਰਸ਼ਨ ਕਰਕੇ ਆਉਣਾ ਹੈ ਜੀ ਇਤਿਹਾਸਿਕ ਜਗ੍ਹਾ ਪਰ ਅਤੇ ਤੁਸੀਂ ਮੈਨੂੰ ਆਪਣਾ ਖਰਚਾ ਦੱਸ ਦਿਉ ਤੁਹਾਡਾ ਖਰਚਾ ਕੀ ਹੈ ਅਤੇ ਪੰਜ ਤਰੀਕ ਨੂੰ ਆਪਾਂ ਨੇ ਰੋਪੜ ਬਜ਼ਾਰ ਕੋਲ ਤੁਸੀਂ ਮੋਰਨਿੰਗ ਟਾਈਮ ਸਾਜਰੇ ਆ ਜਾਣਾ